ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਮੈਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮੰਡੀ ਗੋਬਿੰਦਗੜ੍ਹ ਦਾ ਰਹਿਣੇ ਵਾਲਾ ਹਾਂ ਮੇਰੀ ਉਮਰ ਬਾਈ ਸਾਲ ਹੈ ਅਤੇ ਮੇਰੇ ਘਰੇ ਮੰਮੀ ਡੈਡੀ ਅਤੇ ਭਰਾ ਹੈ ਡੈਡੀ ਮੇਰੇ ਮਿੱਲ ਦੇ ਵਿੱਚ ਵਰਕਰ ਨੇ ਅਤੇ ਮੈਂਨੇ ਆਪਣੀਆਂ ਸਟੱਡੀ ਅੱਠਵੀਂ ਕਲਾਸ ਤੱਕ ਮੈਂ ਆਪਣੇ ਪਿੰਡ ਸਕੂਲ ਵਿੱਚ ਲੱਗਿਆ ਰਿਹਾ ਅਤੇ ਉਸ ਤੋਂ ਬਾਅਦ ਮੈਂ ਨਾਲ ਦੇ ਪਿੰਡ ਲੱਗਿਆ ਅੱ ਨੌਵੀਂ ਤੋਂ ਬਾਰਵੀਂ ਤੱਕ ਮੈਂ ਉੱਥੇ ਹੀ ਕੀਤੀ ਅਤੇ ਬਾਰਵੀਂ ਕੰਪਲੀਟ ਹੋਣ ਤੋਂ ਬਾਅਦ ਮੈਂ ਆਪਣੇ ਨਾਲ ਦੇ ਸ਼ਹਿਰ ਸਰਹਿੰਦ ਰਿਮਟ ਯੂਨੀਵਰਸਿਟੀ ਵਿੱਚ ਆਪਣੀ ਬੀਕੌਮ ਕੰਪਲੀਟ ਕੀਤੀ ਬੀਕੌਮ ਕੰਪਲੀਟ ਕਰਨ ਤੋਂ ਬਾਅਦ ਮੈਂ ਮੰਡੀ ਗੋਬਿੰਦ ਸ਼ਹਿਰ ਦੇ ਵਿੱਚ ਅਕਾਊਂਟੈਂਟ ਦਾ ਕੋਰਸ ਕੀਤਾ ਜੋ ਕਿ ਚਾਰ ਮਹੀਨੇ ਦਾ ਸੀ ਉਹ ਕਰਨ ਤੋਂ ਬਾਅਦ ਮੈਨੂੰ ਐਕਸਲ ਅਤੇ ਟੈਲੀ ਦੀ ਨੌਲੇਜ ਆਈ ਉਹ ਨੌਲੇਜ ਕਰਨ ਨੌਲੇਜ ਆਉਣ ਤੋਂ ਬਾਅਦ ਮੈਨੇ ਲੁਧਿਆਣੇ ਕੰਗਾਰਯੂ ਕੰਪਨੀ ਦੇ ਵਿੱਚ ਇੰਟਰਵਿਊ ਦਿੱਤੀ ਜਿੱਥੇ ਮੇਰੀ ਸਿਲੈਕਸ਼ਨ ਹੋ ਗਈ ਅਤੇ ਹੁਣ ਮੈਂ ਉੱਥੇ ਅਕਾਊਂਟੈਂਟ ਦੀ ਜੋਬ ਕਰਦਾ ਹਾਂ